ਪੰਜਾਬੀ ਪਰਿਵਾਰ ਸਭਿਆਚਾਰਕ ਪਰੰਪਰਾਵਾਂ 'ਤੇ ਕਦਰਾ ਕੀਮਤਾਂ ਨੂੰ ਨੌਜਵਾਨ ਪੀੜ੍ਹੀ ਤੱਕ ਪਹੁੰਚਾਇਆ ਜਾਂਦਾ ਹੈ ਉਹਨਾਂ ਨੂੰ ਸਕੂਲ ਵਿੱਚ ਵੀ ਪੰਜਾਬੀ ਸੱਭਿਆਚਾਰ ਬਾਰੇ ਪੜ੍ਹਾਇਆ ਜਾਂਦਾ ਹੈਗਾ ਅਤੇ ਅਸੀਂ ਉਹਨਾਂ ਨੂੰ ਘਰੇ ਵੀ ਦੱਸਦੇ ਹਾਂ ਨੌਜਵਾਨਾਂ ਨੂੰ ਪੰਜਾਬੀ ਸੱਭਿਆਚਾਰ ਬਾਰੇ ਵਿਆਹਾ 'ਚ ਰਸਮਾਂ ਕੀਤੀਆਂ ਜਾਂਦੀਆਂ ਹਨ ਜਿਵੇਂ ਜਾਗੋ ਕੜਾਹੀ ਚੜ੍ਹਾਈ ਜਾਂਦੀ ਸ਼ੁਰੂ ਤੋਂ ਅਤੇ ਨੌਜਵਾਨ ਜੋ ਬਹੁਤ ਖੁਸ਼ ਹੁੰਦੇ ਨੇ ਵੇਖ ਕੇ ਪੁਰਾਣੇ ਸੱਭਿਆਚਾਰ ਅਤੇ ਪਰੰਪਰਾਵਾਂ ਖੇਡਦੇ ਹਾਂ ਅਸੀਂ ਜਿਵੇਂ ਸੱਭਿਆਚਾਰ ਬਾਰੇ ਪਤਾ ਲੱਗਦਾ ਉਹਨਾਂ ਨੂੰ ਜਦੋਂ ਅਸੀਂ ਖੇਡਦੇ ਹਾਂ ਗੁੱਲੀ ਡੰਡਾ ਖੇਡਦੇ ਜਿਵੇਂ ਅਸੀਂ ਕੋਈ ਰਲ ਮਿਲ ਕੇ ਅਸੀਂ ਕੋਈ ਹੋਰ ਖੇਡ ਖੇਡਦੇ ਦਾ ਵੀ ਦੁੱਖੜੇ ਖੇਡਦੇ ਜਿਵੇਂ ਖੋ ਖੋ ਖੇਡਦੇ ਹਾਂ ਉਹਨਾਂ ਨੂੰ ਪੰਜਾਬੀ ਸੱਭਿਆਚਾਰ ਬਾਰੇ ਪਤਾ ਲੱਗਦਾ ਫਿਰ ਇਸ ਤਰ੍ਹਾਂ ਅਤੇ ਜਿਵੇਂ ਜਾਗੋ ਕੱਢੀ ਜਾਂਦੀ ਹੈ ਵਿਆਹਾਂ 'ਚ ਅਤੇ ਕੜਾਹੀਆਂ ਕੜਾਹੀ ਚੜ੍ਹਾਈ ਜਾਂਦੀ ਹੈਗੀ ਹੋਰ ਬਟਨੇ ਦੀ ਰਸਮ ਕੀਤੀ ਜਾਂਦੀ ਹੈ ਕੁੜੀ ਦੇ ਵਿਆਹ 'ਚ ਮੁੰਡੇ ਦੇ ਵਿਆਹ 'ਚ ਗੀਤ ਗਾਏ ਜਾਂਦੇ ਹਨ ਅਤੇ ਉਹਨਾਂ ਨੂੰ ਸਾਰਾ ਪਤਾ ਲੱਗਦਾ ਗਿੱਧਾ ਪਾਇਆ ਜਾਂਦਾ ਹੈਗਾ ਇਸ ਤਰ੍ਹਾਂ ਉਹਨਾਂ ਨੂੰ ਪੰਜਾਬੀ ਸੱਭਿਆਚਾਰ ਬਾਰੇ ਨੋਲਜ ਆਉਂਦੀ ਹੈ